ਉੱਨੀ ਸੌ ਉਣਾਨਵੇਂ ਵੀਹ ਹਜ਼ਾਰ ਪੰਜ ਸੌ ਸਤਾਸੀ ਦੋ ਲੱਖ ਛਪੰਜਾ ਹਜ਼ਾਰ ਨੌ ਸੌ ਗਿਆਰਾਂ ਨੌ ਲੱਖ ਉਣਾਨਵੇਂ ਹਜ਼ਾਰ ਨੌ ਸੌ ਉਨਤਾਲੀ ਸੱਤ ਲੱਖ ਤ੍ਰੇਹਠ ਹਜ਼ਾਰ ਛੇ ਸੌ ਅਠੱਤੀ